ਪੰਜਾਬੀ ਭਾਸ਼ਾ ਦੀਆਂ ਕੁਝ ਵਿਲੱਖਣ ਵਿਸ਼ੇਸ਼ਤਾਵਾਂ ਹਨ ਪੰਜਾਬੀ ਭਾਸ਼ਾ ਬਹੁਤ ਹੀ ਜ਼ਿਆਦਾ ਵਧੀਆ ਹ ਹੁੰਦੀ ਹੈ ਪੰਜਾਬੀ ਦੀ ਵਿਆਕਰਨ ਵੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਜੋ ਕਿ ਅੱਜ ਕੱਲ੍ਹ ਬੱਚੇ ਬਹੁਤ ਹੀ ਪਹਿਲਾਂ ਬੱਚੇ ਬਹੁਤ ਹੀ ਜ਼ਿਆਦਾ ਵਧੀਆ ਪੜ੍ਹਦੇ ਹੁੰਦੇ ਸੀ ਅਤੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਮਾਂ ਬੋਲੀ ਬੋਲੀ ਕਿਹਾ ਜਾਂਦਾ ਹੈ ਪੰਜਾਬੀ ਭਾਸ਼ਾ ਬਹੁਤ ਜ਼ਿਆਦਾ ਲੋਕ ਬੋਲਦੇ ਹਨ ਪਰ ਜਿਹੜੇ ਅੱਜ ਕੱਲ੍ਹ ਅੰਗਰੇਜ਼ੀ ਸਕੂਲ ਹਨ ਜੋ ਕਿ ਬੱਚਿਆਂ ਨੂੰ ਅੰਗਰੇਜ਼ੀ ਸਕੂਲ ਵਿੱਚ ਲਾਏ ਜਾਂਦਾ ਹੈ ਤਾਂ ਪਰ ਉਹ ਪੰਜਾਬੀ ਨਹੀਂ ਪੜ੍ਹਾਉਂਦੇ ਉਹਨਾਂ ਨੂੰ ਛੇਵੀਂ ਸੱਤਵੀਂ 'ਚ ਪੰਜਾਬੀ ਲੱਗਦੀ ਹੈ ਅਤੇ ਬੱਚੇ ਇੰਨੀ ਜ਼ਿਆਦਾ ਪੰਜਾਬੀ ਨਹੀਂ ਬੋਲ ਸਕਦੇ ਉਹਨਾਂ ਨੂੰ ਬਹੁਤ ਘੱਟ ਪੰਜਾਬੀ ਬੋਲ ਸਕਦੇ ਆ ਪਰ ਪੰਜਾਬ ਵਿੱਚ ਪੰਜਾਬੀ ਨੂੰ ਮਾਂ ਬੋਲੀ ਕਿਹਾ ਜਾਂਦਾ ਜ਼ਜ਼ਤੇ ਤਾਂ ਕਰਕੇ ਜੇ ਆਪਾਂ ਵੈਸੇ ਪੰਜਾਬੀ ਪੜ੍ਹੀ ਹੈ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਕਿਉਂਕਿ ਉਸ ਵਿੱਚ ਬਹੁਤ ਸਾਰੇ ਰੀਤੀ ਰਿਵਾਜ਼ਾਂ ਦਾ ਵੀ ਪਤਾ ਲੱਗਦਾ ਗਾ ਵੀ ਕਿਉਂ ਪੰਜਾਬੀ ਵਿਆਕਰਨ ਵਿੱਚ ਬਹੁਤ ਜ਼ਿਆਦਾ ਦਾ ਪੂਰਾ ਪਤਾ ਲੱਗਦਾ ਇਸ ਲਈ ਪੰਜਾਬ ਵਿੱਚ ਜ਼ਿਆਦਾਤਰ ਪੰਜਾਬੀ ਹੀ ਬੋਲੀ ਜਾਵੇ ਅਤੇ ਜਵਾ ਅੱਜ ਕੱਲ੍ਹ ਪੰਜਾਬੀ ਪੰਜਾਬੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਮਤਲਬ ਕਿ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਜਾਂਦੀਆਂ ਹੈਗੀਆਂ ਪੰਜਾਬੀ ਵਿੱਚ ਅਤੇ ਬਹੁਤ ਸਭ ਦਾ ਹੀ ਕੰਮ ਕਰੇ ਜਾਂਦੇ ਆ ਪੰਜਾਬੀ ਵਿੱਚ ਤਾਂ ਕਰਕੇ ਮੈਂ ਇਹੀ ਚਾਹੁੰਦੀ ਹਾਂ ਕਿ ਪੰਜਾਬ ਵਿੱਚ ਜ਼ਿਆਦਾਤਰ ਪੰਜਾਬੀ ਬੋਲੀ ਜਾਵੇ ਕਿਉਂਕਿ ਪੰਜਾਬ ਵਿੱਚ ਹਰ ਇੱਕ ਨੂੰ ਪੰਜਾਬੀ ਬਿਨਾਂ ਕੋਈ ਵੀ ਵਧੀਆ ਨਹੀਂ ਹੁੰਦਾ ਕਿਉਂਕਿ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਹੁੰਦੀ ਹੈ ਇਸ ਲਈ ਮੈਂ ਸਿਰਫ ਇੰਨਾ ਹੀ ਚਾਹੁੰਦੀ ਹਾਂ ਕਿ ਹਰ ਇੱਕ ਜਵਾਕ ਪੰਜਾਬੀ ਵੱਧ ਤੋਂ ਵੱਧ ਬੋਲਿਆ ਕਰੇ